ਹਾਂਜੀ ਮੈਂ ਨਾ ਤੁਹਾਡੇ ਨਾਲ ਆਪਣੀ ਨਾ ਬਹੁਤ ਪੁਰਾਣੀ ਜਿਹੜੀ ਗੱਲ ਆ ਸਾਂਝੀ ਕਰਦਾ ਕਾਲਜ ਦੇ ਦਿਨਾਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਗਾ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀ ਕਦੇ ਨਾ ਵੀ ਤੁਸੀਂ ਇਸ ਮਟੀ ਇਹ ਤੋਂ ਵੇਸਟ ਮਟੀਰੀਅਲ ਤੋਂ ਕੋਈ ਚੀਜ਼ਾਂ ਬਣਾਓ ਵਧੀਆ ਤਾਂ ਫਿਰ ਮੈਂ ਵੀ ਮੇਰੇ ਧਿਆਨ ਦੇ ਵਿੱਚ ਇੱਕ ਚੀਜ਼ ਆਈ ਫਿਰ ਨਾ ਸਾਡੇ ਨਾਲ ਫਿਊਜ਼ ਹੋਏ ਨਾ ਬਲਬ ਪਏ ਸੀਗੇ ਘਰ ਮੈਂ ਤਿੰਨ ਬਲਬ ਲੈ ਲਏ ਜੀ ਦੋ ਤਾਂ ਵੱਡੇ ਬਲਬ ਲੈ ਲਏ ਇੱਕ ਛੋਟਾ ਲੈ ਲਿਆ ਜੀਰੋ ਵਾਲਾ ਜਿਹੜਾ ਲਾਲ ਜਾ ਬਲਬ ਹੁੰਦਾ ਫਿਰ ਮੈਂ ਸਾਡੇ ਘਰੋਂ ਰੂੰ ਲੈ ਲਈ ਜੀ ਰੂੰ ਐਂ ਕਰਤਾ ਨਾ ਆਪਣਾ ਬਲਬਾਂ ਦੇ ਉੱਪਰ ਦੋ ਵੱਡੇ ਬਲਬਾਂ ਉੱਪਰ ਰੂੰ ਲ ਲਪੇਟ ਤੀ ਐਂ ਵਧੀਆ ਗੋਲ ਗੋਲ ਸੋਫਟ ਸੋਫਟ ਰੂੰ ਵਾਈਟ ਵਾਈਟ ਲਪੇਟ ਤੀ ਉਹਨਾਂ 'ਤੇ ਨਾਲੇ ਛੋਟੇ 'ਤੇ ਲਪੇਟ ਤੀ ਫਿਰ ਮੈਂ ਇੱਕ ਟੋਕਰੀ ਲੈ ਲਈ ਜੀ ਉਸ ਟੋਕਰੀ ਦੇ ਉੱਪਰ ਉਹਦੇ ਆਸੇ ਪਾਸੇ ਮੈਂ ਸਾਰੇ ਨਾ ਉਹਨੂੰ ਚਿੱਟੀ ਰੂੰ ਲਾ ਲਈ ਐਂ ਪੂਰੀ ਵਧੀਆ ਟੋਕਰੀ ਬਣ ਗਈ ਚਿੱਟੀ ਚਿੱਟੀ ਉਹ ਅਤੇ ਫਿਰ ਜਿਹੜੇ ਉਹ ਬਲਬ ਸੀਗੇ ਬਲਬਾਂ ਦੇ ਉੱਪਰ ਮੈਂ ਨਾ ਉਹਦੇ ਦਾਣੇ ਲਾ ਲਏ ਮੂੰਗੀ ਦੇ ਦਾਣੇ ਉਹਦੀਆਂ ਅੱਖਾਂ ਬਣਾ ਲਈਆਂ ਫਿਰ ਉਹਦੇ ਬੁੱਲ ਰੈਡ ਜੇ ਉਹਦੇ ਆਹ ਮੂੰਹ ਬਣਾ ਲਿਆ ਬੁੱਲ ਬਣਾ ਲਏ ਉਹ ਬਾਹਲੀਆਂ ਸੋਹਣੀਆਂ ਬਿੱਲੀਆਂ ਜਿਹੀਆ ਬਣ ਗਈਆ ਕੰਨ ਵੀ ਉਹਦੇ ਮੈਂ ਨਾ ਇਹਦੇ ਆ ਆਪਣੀ ਰੂੰ ਦੇ ਹੀ ਇਹਦੇ ਚਿੱਟੇ ਮੈਂ ਕੰਨ ਲਾ ਲਾ ਤੇ ਅਤੇ ਉਹਨੂੰ ਮੈਂ ਟੋ ਟੋਕਰੀ ਦੇ ਵਿੱਚ ਰੂੰ ਹੋਰ ਪਾ ਤੀ ਟੋਕਰੀ ਦੇ ਵਿੱਚ ਮੂੰਹ ਕੱਢ ਕੇ ਐਂ ਬਿਠਾ ਤੇ ਉਹ ਨਾ ਕਪਲ ਲੱਗਦਾ ਸੀ ਬਿੱਲਾ ਦੇ ਬਿੱਲੀ ਅਤੇ ਇੱਕ ਬਲੂੰਗੜਾ ਨਿੱਕੇ ਬਲਬ ਦਾ ਬਲੂੰਗੜਾ ਬਣ ਗਿਆ ਅਤੇ ਉੱਪਰ ਉਹਦੇ ਮੈਂ ਸਟਾਰ ਵਗੈਰਾ ਲਗਾ ਕੇ ਉਹਨੂੰ ਇੰਨਾਂ ਘੈਂਟ ਬਣਾ ਤਾ ਅਤੇ ਉਹ ਸਾਰੇ ਭਾਈ ਪੂਰਾ ਹੱਸਣ ਜੀ ਸਾਰੇ ਦੇਖਣ ਵੀ ਇਹ ਤਾਂ ਬਹੁਤ ਵਧੀਆ ਚੀਜ਼ ਬਣਾਈ ਹੈ ਅਤੇ ਉਹ ਫਸਟ ਆਇਆ ਸਾਰਿਆਂ ਦੇ ਵਿੱਚੋਂ ਮੇਰਾ ਉਹ ਬਹੁਤ ਵਧੀਆ ਮੈਨੂੰ ਲੱਗਿਆ ਉਹ ਹਾਲੇ ਵੀ ਮੇਰੇ ਯਾਦ ਆ ਤਾਂ ਹੁਣ ਆਹ ਜਿਹੜਾ ਕੀ ਆ ਸਾ ਮੇਰਿਆ ਪੋਤਿਆਂ ਨੇ ਜਾਣਾ ਸੀ ਸਕੂਲ ਦੇ ਵਿੱਚ ਇਹਨਾਂ ਦੇ ਵੀ ਆਹੀ ਸੀ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿਹਾ ਐਂ ਬਣਾਉਣੇ ਫਿਰ ਮੈਂ ਪੂਰੀ ਮਦਦ ਉਹਨਾਂ ਦੀ ਕੀਤੀ ਜਿਵੇਂ ਮੈਂ ਆਪਦਾ ਬਣਾਇਆ ਸੀ ਉਦੋਂ ਵੀ ਜ਼ਿਆਦਾ ਵਧੀਆ ਉਹਨਾਂ ਨੂੰ ਮੈਂ ਬਣਾ ਕੇ ਦਿੱਤਾ ਤਾਂ ਉਹ ਉਹ ਵੀ ਬ ਹੱਸਦੇ ਆ ਅੱਜ ਬੱਚੇ ਕਹਿੰਦੇ ਦਾਦੂ ਤੁਸੀਂ ਵੀ ਐਂਈ ਬਣਾਇਆ ਸੀ ਮੈਂ ਕਿਹਾ ਹਾਂ ਪੁੱਤ ਮੈਂ ਵੀ ਐਂਈ ਬਣਾਇਆ ਸੀਗਾ ਪਰ ਮੈਂ ਤੁਹਾਨੂੰ ਵੀ ਐਂ ਬਣਾ ਕੇ ਦਿੰਦਾ ਹੈਗਾ ਅਤੇ ਉਹ ਦੇਖੋ ਬੱਚਿਆਂ ਦਾ ਵੀ ਮੇਰੇ ਪੋਤਿਆਂ ਦਾ ਵੀ ਐਂ ਪੂਰਾ ਫਸਟ ਆਇਆ ਸਕੂਲ ਦੇ ਵਿੱਚੋਂ ਅਤੇ ਉਹ ਵੀ ਟੀਚਰ ਵੀ ਕਮਾਲ ਮੰਨ ਗਏ ਉਹ ਕਹਿੰਦੇ ਵੀ ਤੁਸੀਂ ਕੀਤਾ ਸਿੱਖਿਆ ਉਹ ਕਹਿੰਦੇ ਸਾਡੇ ਦਾਦੇ ਨੇ ਸਿਖਾਇਆ ਹੈਗਾ ਜਦੋਂ ਉਹਨਾਂ ਨੇ ਘਰ ਆ ਕੇ ਦੱਸਿਆ ਨਾ ਕਹਿੰਦੇ ਦਾਦਾ ਅਤੇ ਕਹਿੰਦੇ ਸਾਡੀ ਮੈਡਮ ਬਹੁਤ ਖੁਸ਼ ਹੋਏ ਵੀ ਜਿਹੜਾ ਤੁਸੀਂ ਆਪਦੇ ਤੁਹਾਡੇ ਦਾਦੇ ਨੇ ਸਿਖਾਈ ਏ ਤੁਹਾਨੂੰ ਇੰਨੀ ਵਧੀਆ ਬਿੱਲੀਆਂ ਬਣਾਉਣੀਆਂ ਹਾਂਜੀ ਉਹ ਬਹੁਤ ਵਧੀਆ ਬਿੱਲੀਆਂ ਜਿਹੀਆਂ ਬਣ ਗਈਆਂ ਸੀਗੀਆਂ ਅਤੇ ਬਹੁਤ ਸੁੰਦਰ ਵੀ ਲੱਗਦੀਆਂ ਹੈਗੀਆਂ ਐਂ ਸੋਫਟ ਸੋਫਟ ਜਿਹੀਆਂ ਵਾਈਟ ਵਾਈਟ ਹਾਂਜੀ ਹਾਂਜੀ ਓਕੇ